ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਸਿਲਾਈ ਕਢਾਈ ਵਗੈਰਾ ਦਾ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੇ ਕੋਲ ਹੈਗੇ ਆ ਜੀ ਦੋ ਤਿੰਨ ਬੰਦੇ ਆਪਾਂ ਦੇਖਦੇ ਹਾਂ ਵੀ ਜਿਹੜੀ ਵਧੀਆ ਕੋਈ ਸਕਿੱਲਸ ਕੋਈ ਨਾ ਆਪਾਂ ਹਾਂਜੀ ਹਾਂਜੀ ਜਿਹਨੂੰ ਵਧੀਆ ਨੌਲੇਜ ਹੋਵੇ ਜਿਹਨੂੰ ਵਧੀਆ ਸਕਿੱਲਸ ਹੋਣ ਆਪਾਂ ਉਹ ਬੰਦੇ ਨੂੰ ਬੁਲਾਉਂਦੇ ਹਾਂ ਨਾਲੇ ਜੇ ਆਪਾਂ ਦੇਖਦੇ ਹਾਂ ਸਰਕਾਰੀ ਬੰਦਾ ਮਿਲ ਜਾਵੇ ਜਿਹਦੇ ਨਾਲ ਆਪਾਂ ਨੂੰ ਕੋਈ ਸਰਟੀਫਿਕੇਟ ਵੀ ਬੱਚਿਆਂ ਨੂੰ ਦੇ ਦਈਏ ਆਪਾਂ ਬੱਚਿਆਂ ਨੂੰ ਅੱਗੇ ਕੰਮ ਆਵੇ ਹਾਂਜੀ ਹਾਂਜੀ ਜ਼ਰੂਰ ਮੇਰੇ ਕੋਲ ਹੈ ਦੋ ਤਿੰਨ ਬੰਦੇ ਮੈਂ ਉਹਨਾਂ ਨਾਲ ਗੱਲ ਕਰਕੇ ਬਸ ਇੱਕ ਅੱਧੇ ਦਿਨ 'ਚ ਫਾਈਨਲ ਕਰਕੇ ਅਤੇ ਫੇਰ ਮੈਂ ਦੱਸ ਹਾਂਜੀ ਵੈਸੇ ਇਹ ਤਾਂ ਹੈ ਗਰਮੀ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਆਪਾਂ ਕੋਈ ਨਹੀਂ ਦੋ ਤਿੰਨ ਘੰਟੇ ਬੱਚੇ ਰਹਿਣ ਬੀਜ਼ੀ ਇੱਧਰ ਆਪਾਂ ਮੈਂ ਗੱਲ ਕਰ ਫਿਰ ਆਪਾਂ ਕਰਾਉਂਦੇ ਹਾਂ ਉਹ ਕੰਮ ਠੀਕ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਮੈਂ ਇੱਕ ਦੋ ਦਿਨਾਂ 'ਚ ਹੱਲ ਕਰਕੇ ਫਿਰ ਤੁਹਾਨੂੰ ਦੱਸਦੀ ਹਾਂ ਚਲੋ ਫੇਰ ਆਪਾਂ ਕੰਮ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਓਕੇ ਧੰਨਵਾਦ